ਨਮਸਕਾਰ ਮੇਰਾ ਨਾਮ ਪੂਜਾ ਦੇਵੀ ਹੈ ਅਤੇ ਮੈਂ ਪਠਾਨਕੋਟ ਦੀ ਰਹਿਣ ਵਾਲੀ ਹਾਂ ਪਠਾਨਕੋਟ ਦੇ ਨਾਲ ਪਿੰਡ ਢੇਸੀਆਂ ਖੂਹ ਬਾਈ ਢੇਸੀਆਂ ਹੈ ਜਿਸ ਵਿੱਚ ਸਾਡੇ ਖੇਤਰ ਵਿੱਚ ਬਹੁਤ ਸਾਰੇ ਕਾਰੋਬਾਰ ਖੁੱਲ੍ਹ ਸਕਦੇ ਹਨ ਜਿਵੇਂ ਕਿ ਪਿੰਡ ਵਿੱਚ ਪਿੰਡ ਵਿੱਚ ਰਹਿੰਦੇ ਅਤੇ ਪਿੰਡ ਪਿੰਡ ਵਿੱਚ ਬਹੁਤ ਸਾਰੇ ਜੱਟ ਲੋਕ ਰਹਿੰਦੇ ਹਨ ਅਤੇ ਉਹਨਾਂ ਕੋਲ ਗਾਈਆਂ ਮੱਝਾਂ ਬਹੁਤ ਹਨ ਜਿਨ੍ਹਾਂ ਨਾਲ ਸਾਡੇ ਪਿੰਡ ਵਿੱਚ ਡੇਅਰੀ ਦਾ ਕੰਮ ਖੁੱਲ੍ਹ ਸਕਦਾ ਹੈ ਡੇਅਰੀ ਦੇ ਕੰਮ ਨਾਲ ਕਿ ਜਿਸ ਵਿੱਚ ਦਹੀਂ ਦੁੱਧ ਅਤੇ ਪਨੀਰ ਬਹੁਤ ਸਾਰੇ ਪਦਾਰਥ ਬਣਦੇ ਹਨ ਅਤੇ ਇੱਥੇ ਬਹੁਤ ਹੀ ਅੱਛਾ ਕੰਮ ਚੱਲਦਾ ਹੈ ਅਤੇ ਇਸ ਦੇ ਨਾਲ ਸਾਡੇ ਪਿੰਡ ਦੀਆਂ ਔਰਤਾਂ ਆਪਣੇ ਘਰ ਵਿੱਚ ਸਿਲਾਈ ਸੈਂਟਰ ਖੋਲ੍ਹ ਸਕਦੀਆਂ ਹਨ ਅਤੇ ਆਪਣਾ ਕਾਰੋਬਾਰ ਚਲਾ ਸਕਦੀਆਂ ਹਨ ਅਤੇ ਅੱਜ ਦੇ ਨੌਜਵਾਨ ਆਪਣੇ ਘਰ ਵਿੱਚ ਟਿਊਸ਼ਨਾਂ ਪੜ੍ਹਾ ਕੇ ਆਪਣੇ ਪਿੰਡ ਦੇ ਬੱਚਿਆਂ ਨੂੰ ਪੜ੍ਹਾ ਕੇ ਆਪਣੇ ਘਰ ਕਾਰੋਬਾਰ ਖੋਲ੍ਹ ਸਕਦੇ ਹਨ ਅਤੇ ਜੋ ਬੱਚੇ ਸ਼ਹਿਰ ਵਿੱਚ ਪੜ੍ਹਨ ਜਾਂਦੇ ਹਨ ਉਹ ਪਿੰਡ ਵਿੱਚ ਪੜ੍ਹ ਸਕਦੇ ਹਨ ਧੰਨਵਾਦ